ਮੈਨੂੰ ਵੈਸੇ ਤਾਂ ਬਹੁਤ ਸਾਰੀਆਂ ਖੇਡਾਂ ਪਸੰਦ ਹਨ ਪਰ ਸਭ ਤੋਂ ਜ਼ਿਆਦਾ ਪਸੰਦ ਮੈਨੂੰ ਚਿੜੀ ਛਿੱਕਾ ਖੇਡਣਾਂ ਹੈ ਜੋ ਕਿ ਮੈਨੂੰ ਬਹੁਤ ਹੀ ਪਸੰਦ ਹੈ ਆਰ ਪੀ ਜੀ ਅਤੇ ਪੀ ਐ ਪੀ ਐਸ ਰਾਜਨੀਤਿਕ ਵਰਗੀਆਂ ਗੇਮਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹਨ ਜੋ ਫੋਨ ਵਿੱਚ ਖੇਡੀਆਂ ਜਾਂਦੀਆਂ ਹਨ ਫੋਨ ਵਿੱਚ ਤਾਂ ਬਹੁਤ ਸਾਰੀਆਂ ਗੇਮਾਂ ਹਨ ਜਿਸ ਵਿੱਚੋਂ ਮੈਂ ਕੁਝ ਗੇਮਾਂ ਖੇਡਣੀਆਂ ਹੀ ਪਸੰਦ ਕਰਦੀ ਹਾਂ ਪਰ ਮੈਨੂੰ ਜ਼ਿਆਦਾਤਰ ਖੁਦ ਅਪ ਖੇਡਣਾ ਬਾਹਰ ਜਾ ਕੇ ਖੇਡਣਾ ਹੀ ਪਸੰਦ ਹੈ ਅਹੀਂ ਅਸੀਂ ਆਪਣੇ ਸਕੂਲ ਜਾਂ ਕਾਲਜ ਵਿੱਚ ਵੀ ਚਿੜੀ ਛਿੱਕਾ ਖੇਡਦੇ ਹਾਂ ਜੋ ਕਿ ਸਾਨੂੰ ਬਹੁਤ ਹੀ ਪਸੰਦ ਹੈ ਮੇਰੀ ਸਭ ਤੋਂ ਮਨਪਸੰਦ ਗੇਮ ਇਹ ਹੀ ਹੈ ਜੋ ਕਿ ਸਭ ਨੂੰ ਹੀ ਖੇਡਣੀ ਚਾਹੀਦੀ ਹੈ ਫੋਨ ਵਿੱਚ ਘੱਟ ਗੇਮਾਂ ਖੇਡਣ ਚਾਹੀਦੀਆਂ ਹਨ ਆਰ ਪੀ ਜੀ ਅਤੇ ਪੀ ਐੱਫ ਪੀ ਐਸ ਵਰਗੀਆਂ ਗੇਮਾਂ ਫੋਨ ਵਿੱਚ ਖੇਡਣੀਆਂ ਕਈ ਜਣਿਆਂ ਨੂੰ ਪਸੰਦ ਹਨ ਪਰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹਨ ਜੋ ਕਿ ਇੱਕ ਤਰ੍ਹਾਂ ਦੀਆਂ ਸ਼ੂਟਿੰਗ ਗੇਮਾਂ ਹਨ ਬਿਲਕੁਲ ਉਹ ਗੇਮਾਂ ਤਾਂ ਜ਼ਿਆਦਾਤਰ ਮੁੰਡੇ ਹੀ ਖੇਡਦੇ ਹਨ ਪਰ ਮੈਨੂੰ ਇਹ ਗੇਮਾਂ ਖੇਡਣੀਆਂ ਬਿਲਕੁਲ ਵੀ ਪਸੰਦ ਨਹੀਂ ਹੈ ਰਾਜਨੀਤੀ ਵਿੱਚ ਵੀ ਕਈ ਸਾਰੀਆਂ ਗੇਮਾਂ ਹੁੰਦੀਆਂ ਹਨ ਰਣਨੀਤੀ ਵਿੱਚ ਵੀ ਕਈ ਸਾਰੀਆਂ ਗੇਮਾਂ ਹੁੰਦੀਆਂ ਹਨ ਜੋ ਕਿ ਮੈਨੂੰ ਪਸੰਦ ਹਨ ਪਰ ਇੰਨੀਆਂ ਜ਼ਿਆਦਾ ਪਸੰਦ ਨਹੀਂ ਹਨ